ਮੈਂ ਸਿੱਖ ਧਰਮ ਦੇ ਨਾਲ ਸੰਬੰਧਿਤ ਹਾਂ ਹਾਂ ਸਾਡਾ ਧਰਮ ਸਾਨੂੰ ਸਿਹਤ ਸੰਭਾਲ ਦੇ ਨਾਲ ਜੋੜਨਾ ਸਿਖਾਉਂਦਾ ਹੈ ਅਤੇ ਕਿਵੇਂ ਸਿਹਤ ਦਾ ਧਿਆਨ ਰੱਖਣਾ ਹੈ ਉਸਦੇ ਬਾਰੇ ਚੰਗੀ ਤਰ੍ਹਾਂ ਸਿਖਾਉਂਦਾ ਹੈ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਸਵੇਰੇ ਚਾਰ ਵਜੇ ਉੱਠਣ ਤੋਂ ਬਾਅਦ ਕਸਰਤ ਕਰਨਾ ਭੱਜ ਦੌੜ ਕਰਨਾ ਅਤੇ ਇਸ ਤੋਂ ਇਲਾਵਾ ਜਿਮਨਾਸਟਿਕ ਕਰਨਾ ਅਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਨਹਾ ਕੇ ਰੱਬ ਦਾ ਨਾਮ ਲੈਣਾ ਪਾਠ ਪੂਜਾ ਕਰਨਾ ਸਿਖਾਉਂਦਾ ਹੈ ਅਤੇ ਜਿਸ ਦੇ ਨਾਲ ਆਪਣੇ ਸਰੀਰ ਦੇ ਨਾਲ ਨਾਲ ਮਾਨਸਿਕ ਤੌਰ 'ਤੇ ਸੰਤੁਲਿਤ ਰਹਿਣਾ ਸਿਖਾਉਂਦਾ ਹੈ ਅਤੇ ਇਸ ਤੋਂ ਇਲਾਵਾ ਸਿੱਖ ਧਰਮ ਦੇ ਵਿੱਚ ਜਿਵੇਂ ਕਿ ਗੱਤਕਾ ਹੈ ਗੱਤਕਾ ਇੱਕ ਤਰ੍ਹਾਂ ਦੀ ਖੇਡ ਪ੍ਰਕਿਰਿਆ ਹੈ ਜੋ ਕਿ ਨੌਜਵਾਨ ਮੁੰਡੇ ਅਤੇ ਦੋਵੇਂ ਕੁੜੀਆਂ ਦੇ ਲਈ ਕਾਫੀ ਜ਼ਿਆਦਾ ਸਰੀਰਕ ਤੌਰ 'ਤੇ ਫਿਟ ਰਹਿਣ ਦੇ ਲਈ ਕਾਬਲ ਹੁੰਦਾ ਹੈ ਇਹ ਇੱਕ ਯੁੱਧ ਪ੍ਰਕਿਰਿਆ ਹੈ ਯੁੱਧ ਦੇ ਵਿੱਚ ਕਿਵੇਂ ਲੜਨਾ ਹੈ ਉਸ ਦੇ ਉਸ ਦੇ ਬਾਰੇ ਚੰਗੀ ਤਰ੍ਹਾਂ ਸਿਖਾਉਂਦਾ ਹੈ ਗੱਤਕਾ ਇੱਕ ਬਹੁਤ ਹੀ ਖੇਡ ਕਰਤੱਵ ਹੈ ਜੋ ਕਿ ਹਰ ਕਿਸੇ ਨੂੰ ਸਿੱਖਣਾ ਚਾਹੀਦਾ ਹੈ